ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਕਰ ਸੰਕ੍ਰਾਂਤੀ ਆਉਂਦੀ ਹੈ ਜੋ ਕਿ ਹਰ ਮਹੀਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਮਨਾਈ ਜਾਂਦੀ ਹੈ ਇਸ ਸੰਕ੍ਰਾਂਤੀ ਵਾਲੇ ਦਿਨ ਵੱਖ ਵੱਖ ਧਰਮਾਂ ਦੇ ਲੋਕ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਨ ਉੱਥੇ ਆ ਕੇ ਨਮਸਤਕ ਹੁੰਦੇ ਹਨ ਅਤੇ ਉਹਨਾਂ ਬੱਚਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਕਿ ਇੱਥੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣਵਾ ਦਿੱਤੇ ਗਏ ਸਨ ਇਹਨਾਂ ਬੱਚਿਆਂ ਨੇ ਆਪਣੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ ਸੀ ਇਹ ਬੱਚੇ ਹਨ ਗੁਰੂ ਗੋਬਿੰਦ ਸਾਹਿਬ ਜੀ ਦੇ ਜਿਹੜੇ ਕਿ ਸਿੱਖਾਂ ਦੇ ਦਸਵੇਂ ਗੁਰੂ ਹਨ ਇਨ੍ਹਾਂ ਬੱਚਿਆਂ ਨੇ ਆਪਣੇ ਧਰਮ ਦੀ ਖਾਤਰ ਇਸ ਜਗ੍ਹਾ ਦੇ ਉੱਤੇ ਜਿਹੜਾ ਕਿ ਫਤਿਹਗੜ੍ਹ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਉਸ ਜਗ੍ਹਾ ਦੇ ਉੱਤੇ ਸ਼ਹੀਦੀ ਦੇ ਦਿੱਤੀ ਸੀ ਹੁਣ ਜਦੋਂ ਕਿ ਆਪਾਂ ਅੱਗੇ ਸ਼ਹੀਦੀ ਤੋਂ ਅੱਗੇ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਨਾਲ ਹੀ ਇੱਥੇ ਥੋੜ੍ਹੀ ਦੂਰੀ 'ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ ਜਿਸ ਜਗ੍ਹਾ ਦੇ ਉੱਤੇ ਇਹਨਾਂ ਬੱਚਿਆਂ ਦਾ ਸਸਕਾਰ ਕੀਤਾ ਗਿਆ ਸੀ ਇਸ ਦੇ ਵਾਸਤੇ ਇਹਦੇ ਨਾਲ ਹੀ ਆਪਾਂ ਦੂਸਰਾ ਜਿਹੜਾ ਹੈ ਸ਼ਹੀਦੀ ਜੋੜ ਮੇਲੇ ਦੀ ਗੱਲ ਕਰ ਸਕਦੇ ਹਾਂ ਜੋ ਕਿ ਗਿਆਰ੍ਹਾਂ ਬਾਰ੍ਹਾਂ ਤੇਰ੍ਹਾਂ ਪੋਹ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਇਸ ਜੋੜ ਮੇਲੇ ਵਿੱਚ ਵੀ ਸਾਰੇ ਥਾਵਾਂ ਤੋਂ ਲੋਕ ਆਉਂਦੇ ਹਨ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਹਨ ਅਤੇ ਉਹਨਾਂ ਬੱਚਿਆਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਬੱਚਿਆਂ ਨੇ ਆਪਣੇ ਧਰਮ ਦੀ ਖਾਤਰ ਇਸ ਜਗ੍ਹਾ ਦੇ ਉੱਤੇ ਸ਼ਹੀਦੀ ਦੇ ਦਿੱਤੀ ਸੀ ਇਸ ਲਈ ਜੇ ਆਪਾਂ ਸਰਹੰਦ ਦੀ ਗੱਲ ਕਰੀਏ ਤਾਂ ਉੱਥੇ ਆਮ ਤੌਰ 'ਤੇ ਦੋ ਜਿਹੜੇ ਨੇ ਖਾਸ ਆਪਾਂ ਗੱਲ ਕਰੀਏ ਕਿ ਸੱਭਿਆਚਾਰਕ ਇਵੈਂਟਸ ਜਿਹੜੇ ਸੀਗੇ ਉਹ ਹੋਏ ਸੀ ਇਸ ਕਰਕੇ ਮੈਨੂੰ ਤਾਂ ਮੇਰੇ ਵਿਚਾਰ ਦੇ ਅਨੁਸਾਰ ਦੇ ਨਾਲ ਤਾਂ ਇਹੀ ਸਾਡੀਆਂ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਹਨ